ਮੈਂ ਹਿਮਾਚਲ ਤੋਂ ਕਿੰਨੂ ਦਾ ਬੂਟਾ ਲੈ ਕੇ ਆਉਂਦਾ ਅਤੇ ਮੈਂ ਬਗੀਚੇ ਦੇ ਵਿੱਚ ਲਗਾਇਆ ਅਤੇ ਉਹਦੇ ਉਹਦੀ ਦੇਖਭਾਲ ਕੀਤੀ ਪਾਣੀ ਲ ਪਾਇਆ ਅਤੇ ਰੇਹ ਪਾਈ ਵਿੱਚ ਤਾਂ ਉਹ ਵਧੀਆ ਤਰੀਕੇ ਨਾਲ ਪੈਦਾਵਾਰ ਨਹੀਂ ਹੋ ਸਕੀ ਬਗੀਚੇ ਦੇ ਵਿੱਚ ਅਤੇ ਕਾਫੀ ਜ਼ਿਆਦਾ ਸੁੱਕੀ ਜਾ ਰਿਹਾ ਅਤੇ ਮੈਂ ਕਾਫੀ ਜ਼ਿਆਦਾ ਕੇਅਰ ਕਰਦਾ ਪਰ ਉਹ ਚੰਗੀ ਤਰ੍ਹਾਂ ਬਗੀਚੇ ਦੇ ਵਿੱਚ ਹੋ ਨਾ ਸਕਿਆ